ਮੈਂ ਸ਼ਹੀਦ ਭਗਤ ਸਿੰਘ ਦਾ ਨਿਵਾਸੀ ਹਾਂ ਇੱਥੇ ਆਵਾਜਾਈ ਦੇ ਬਹੁਤ ਸਾਰੇ ਸਾਵਣ ਸਾਧਨ ਹਨ ਜਿਨ੍ਹਾਂ ਵਿੱਚ ਟੈਂਪੂ ਹਨ ਜਿਹੜੇ ਬੰਦਿਆਂ ਨੂੰ ਇੱਧਰ ਉੱਧਰ ਜਾਣ ਵਿੱਚ ਆਸਾਨੀ ਹੁੰਦੀ ਹੈ ਅਤੇ ਇੱਥੇ ਟਰਾ ਸਮਾਨ ਦੇ ਢੋਅ ਢੁਆਣ ਨਾਲ ਢੋਆਉਣ ਲਈ ਇੱਥੇ ਟਰੈਕਟਰ ਅਤੇ ਟਰੱਕਾਂ ਦੀ ਕਾਫੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਬਹੁਤ ਸਾਰੇ ਸਮਾਨ ਲੋਡ ਹੋ ਕੇ ਇੱਧਰ ਅਤੇ ਉੱਧਰ ਭੇਜਿਆ ਜਾਂਦਾ ਹੈ ਅਤੇ ਬੱਸਾਂ ਵਿੱਚ ਵੀ ਬ ਕਈ ਤਰ੍ਹਾਂ ਦੀਆਂ ਬੱਸਾਂ ਹਨ ਜਿਹੜੇ ਮਹਿੰਗੇ ਬੱਸ ਹਨ ਏ ਸੀ ਵਾਲੇ ਵੀ ਬੱਸ ਹਨ ਅਤੇ ਬਿਨਾਂ ਏ ਸੀ ਵਾਲੇ ਵੀ ਬੱਸ ਹਨ ਜੋ ਬੰਦਿਆਂ ਨੂੰ ਕਾਫੀ ਜਲਦੀ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾ ਦਿੰਦੀਆਂ ਹਨ